ਮੈਂ ਇਸ ਗੱਲ ਤੋਂ ਬਿਲਕੁਲ ਚੰਗੀ ਤਰ੍ਹਾਂ ਸਹਿਮਤ ਹਾਂ ਕਿ ਗਰੀਬੀ ਚੰਗੇ ਡਾਕਟਰੀ ਦੇ ਕੋਲ ਦੇਖਭਾਲ ਤੱਕ ਪਹੁੰਚਣ ਦੇ ਵਿੱਚ ਇੱਕ ਰੁਕਾਵਟ ਹੈ ਕਿਉਂਕਿ ਡਾਕਟਰੀ ਇਲਾਜ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਮਹਿੰਗੇ ਹੋ ਚੁੱਕੇ ਹਨ ਅਤੇ ਜੋ ਕਿ ਟੈਸਟ ਹੁੰਦੇ ਹਨ ਹਰ ਇੱਕ ਬਿਮਾਰੀ ਦੇ ਰਿਲੇਟਿਡ ਉਹ ਬਹੁਤ ਹੀ ਜ਼ਿਆਦਾ ਮਹਿੰਗੇ ਰੇਟਾਂ 'ਤੇ ਹੋ ਰਹੇ ਹਨ ਜਿਸ ਕਰਕੇ ਇੱਕ ਆਮ ਗਰੀਬ ਬੰਦਾ ਉਹ ਟੈਸਟ ਨਹੀਂ ਕਰਵਾ ਸਕਦਾ ਅਤੇ ਇਸੇ ਲਈ ਉਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਹੋਣ ਵਾਲੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਕਰਕੇ ਵੀ ਮਰ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਜਿਹੜੀਆਂ ਆਮ ਜੈਨੇਰਿਕ ਦਵਾਈਆਂ ਹਨ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਹਨ ਅਤੇ ਦਵਾਈਆਂ ਦੇ ਰੇਟਾਂ ਦੇ ਨਾਲ਼ ਨਾਲ਼ ਡਾਕਟਰਾਂ ਦੀਆਂ ਨੋਰਮਲ ਫੀਸਾਂ ਵਧਾ ਵਧਾ ਕੇ ਬਹੁਤ ਜ਼ਿਆਦਾ ਕਰ ਰੱਖੀਆਂ ਹਨ ਤਾਂ ਇਸ ਕਰਕੇ ਜੋ ਗਰੀਬ ਬੰਦਾ ਹੈ ਉਹ ਡਾਕਟਰੀ ਇਲਾਜ ਦੇ ਕੋਲ ਜਾਣ ਦੇ ਲਈ ਪਰਹੇਜ਼ ਕਰਦਾ ਹੈ ਕਿਉਂਕਿ ਉਸ ਦੇ ਲਈ ਇੰਨੇ ਪੈਸੇ ਨਹੀਂ ਹੁੰਦੇ ਜਿਸ ਨਾਲ਼ ਉਹ ਆਪਣਾ ਇਲਾਜ ਕਰਵਾ ਸਕੇ ਅਤੇ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਜਿਸਦੀ ਘੱਟੋ ਘੱਟ ਫੀਸ ਪੰਜ ਤੋਂ ਦਸ ਰੁਪਏ ਹੋਣੀ ਚਾਹੀਦੀ ਹੈ ਅਤੇ ਉੱਤੋਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਆਮ ਟੈਸਟ ਫ੍ਰੀ ਹੋਣੇ ਚਾਹੀਦੇ ਹਨ ਅਤੇ ਜਿੰਨੀਆਂ ਵੀ ਦਵਾਈਆਂ ਹੋਣੀਆਂ ਚਾਹੀਦੀਆਂ ਨੇ ਉਹ ਬਿਲਕੁਲ ਫ੍ਰੀ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਹਰ ਇੱਕ ਗਰੀਬ ਬੰਦਾ ਅਤੇ ਮੱਧ ਵਰਗ ਪਰਿਵਾਰ ਦੇ ਨਾਲ਼ ਸੰਬੰਧ ਰੱਖਦਾ ਹੈ ਉਹ ਉੱਥੋਂ ਆਪਣਾ ਇਲਾਜ ਕਰਵਾ ਸਕੇ ਅਤੇ ਇਸ ਦੇ ਨਾਲ਼ ਹੀ ਜੇ ਆਮ ਜਨਤਾ ਗਰੀਬ ਬੰਦੇ ਅਤੇ ਮੱਧ ਵਰਗ ਦੇ ਬੰਦੇ ਜਾਂ ਲੋਕ ਸੁਖੀ ਹੋਣਗੇ ਸੁਖੀ ਤਾਂ ਹੋਣਗੇ ਜੇ ਉਹ ਤੰਦਰੁਸਤ ਹੋਣਗੇ ਤਾਂ ਉਹ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਅਤੇ ਦੇਸ਼ ਦੇ ਵਿਕਾਸ ਦੇ ਲਈ ਆਪਣਾ ਯੋਗਦਾਨ ਪਾ ਸਕਣਗੇ ਜੇ ਆਮ ਜਨਤਾ ਗਰੀਬ ਲੋਕ ਜਾਂ ਮੱਧ ਵਰਗ ਦੇ ਲੋਕ ਹੀ ਬਿਮਾਰੀਆਂ ਨਾਲ਼ ਮਰ ਜਾਣਗੇ ਤਾਂ ਦੇਸ਼ ਦਾ ਵਿਕਾਸ ਕਿਵੇਂ ਹੋ ਸਕਦਾ ਇਸ ਲਈ ਮੈਂ ਇਹ ਸੁਝਾਅ ਦਿੰਦਾ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਜ਼ਰੂਰ ਹੋਣੀ ਚਾਹੀਦੀ ਹੈ